ਕੱਲ ਦੀ ਗੱਲ ਹੈ ਕਿ ਮੈਂ ਓਮੈਕਸ ਮੋਲ ਦੇ ਵਿੱਚ ਮੂਵੀ ਦੇਖਣ ਲਈ ਗਈ ਪਰ ਰਸ਼ ਹੋਣ ਕਰਕੇ ਮੈਨੂੰ ਟਿਕਟ ਨਹੀਂ ਮਿਲੀ ਉਸਦੇ ਚਲਦੇ ਮੈਂ ਸ਼ੌਪਿੰਗ ਕਰਨ ਦੇ ਲਈ ਚਲੀ ਗਈ ਜਿੱਥੇ ਬਹੁਤ ਸਾਰੀਆਂ ਸੇਲਾਂ ਲੱਗੀਆਂ ਸਨ ਸਰਦੀਆਂ ਦੇ ਕੱਪੜਿਆਂ ਦੇ ਉੱਤੇ ਪੰਜਾਹ ਤੋਂ ਸੱਠ ਪਰਸੈਂਟ ਦੀ ਛੂਟ ਸੀ ਬਹੁਤ ਹੀ ਜ਼ਿਆਦਾ ਵਧੀਆ ਵਰੈਟੀ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕੀ ਲਵਾਂ ਤੇ ਕੀ ਕੀ ਛੱਡਾਂ ਅਸੀਂ ਬਹੁਤ ਸਾਰੀ ਸ਼ੌਪਿੰਗ ਕੀਤੀ ਜਿਹਦੇ ਵਿੱਚ ਮੈਨੇ ਦੋ ਕੋਟ ਤਿੰਨ ਸਵੈਟਰਾਂ ਅਤੇ ਇੱਕ ਸੂਟ ਲਿੱਤਾ ਮੈਨੂੰ ਬਹੁਤ ਹੀ ਮਜ਼ਾ ਆਇਆ ਉਸ ਤੋਂ ਬਾਅਦ ਅਸੀਂ ਡਿਨਰ ਕਰਨ ਬਾਹਰ ਚਲੇ ਗਏ ਅਤੇ ਸਾਰਿਆਂ ਨੇ ਆਪਣੇ ਮਨਪਸੰਦ ਦੀਆਂ ਚੀਜ਼ਾਂ ਔਡਰ ਕੀਤੀਆਂ ਅਤੇ ਖੂਬ ਫੈਮਿਲੀ ਦੇ ਨਾਲ ਬੈਠ ਕੇ ਇੰਜੋਏ ਕੀਤਾ ਕਾਫੀ ਲੇਟ ਹੋ ਗਏ ਸੀ ਹਵਾ ਬਹੁਤ ਠੰਡੀ ਚੱਲ ਰਹੀ ਸੀ ਅਤੇ ਅਸੀਂ ਘਰ ਆਏ ਅਤੇ ਸੌ ਗਏ